ਦਸ ਨਵੰਬਰ ਉੱਨੀ ਸੌ ਅੱਸੀ ਨੌ ਜੁਲਾਈ ਉੱਨੀ ਸੌ ਤ੍ਰਿਆਸੀ ਦਸ ਫਰਵਰੀ ਦੋ ਹਜ਼ਾਰ ਨੌ ਉੱਨੀ ਨਵੰਬਰ ਦੋ ਹਜ਼ਾਰ ਨੌ ਇੱਕੀ ਦਸੰਬਰ ਦੋ ਹਜ਼ਾਰ ਵੀਹ